ਪਹਿਲਾਂ ਪਹਿਲਾਂ ਤਾਂ ਮੈਂ ਹਰ ਚੀਜ਼ ਪੈੱਨ ਕਾਗਜ਼ ਅਤੇ ਕਾਗਜ਼ ਜਾਂ ਇੱਕ ਡਾਇਰੀ 'ਤੇ ਹੀ ਲਿਖਦੀ ਸੀ ਆਪਣੀ ਹਰ ਛੋਟੀ ਤੋਂ ਛੋਟੀ ਚੀਜ਼ ਨੂੰ ਵੀ ਮੈਂ ਡਾਇਰੀ 'ਤੇ ਨੋਟ ਕਰਕੇ ਰੱਖਦੀ ਸੀ ਆਪਣੀ ਦਿਨ ਚਰਿਆ ਨੂੰ ਕਿਵੇਂ ਬਿ ਬਿਤਾਉਣਾ ਇਹ ਸਭ ਚੀਜ਼ਾਂ ਮੈਂ ਇੱਕ ਡਾਇਰੀ 'ਤੇ ਲਿੱਖ ਕੇ ਰੱਖਦੀ ਸੀ ਬਟ ਜਿਵੇਂ ਜਿਵੇਂ ਲੈਪਟੋਪ ਮੋਬਾਈਲ ਦਾ ਆਵਿਸ਼ਕਾਰ ਹੋਇਆ ਅਸੀਂ ਮੈਂ ਆਪਣਾ ਸ਼ਡਿਊਲ ਹੈ ਜਿਹੜਾ ਕਿ ਉਹ ਉਸ 'ਤੇ ਬਣਾ ਕੇ ਰੱਖਦੀ ਹਾਂ ਅਤੇ ਟਾਈਮ ਟੂ ਟਾਈਮ ਸੈੱਟ ਕਰਦੀ ਰਹਿੰਦੀ ਹਾਂ ਅਤੇ ਟੂ ਟਾਈਮ ਅਪਡੇਟ ਕਰਦੀ ਰਹਿੰਦੀ ਹਾਂ ਜਿਸ ਨਾਲ਼ ਕਿ ਮੈਨੂੰ ਜ਼ਿਆਦਾ ਮਤਲਬ ਸਟਰੈੱਸ ਨਹੀਂ ਲੈਣਾ ਪੈਂਦਾ ਮੈਨੂੰ ਮੇਰਾ ਜਿਹੜਾ ਸ਼ਡਿਊਲ ਹੈ ਉਹ ਦੇਖ ਕੇ ਹੀ ਪਤਾ ਲੱਗ ਜਾਂਦਾ ਕਿ ਮੈਂ ਇਸ ਟਾਈਮ ਕੀ ਕਰਨਾ ਅਤੇ ਕੀ ਨਹੀਂ ਕਰਨਾ ਮੈਨੂੰ ਆਪਣੀ ਡਾਇਰੀ ਚੱਕ ਕੇ ਦੇਖਣ ਦੀ ਲੋੜ ਵੀ ਨਹੀਂ ਮੈਂ ਸਿੱਧਾ ਮੋਬਾਈਲ ਤੋਂ ਆਪਣਾ ਸ਼ਡਿਊਲ ਨੂੰ ਦੇਖ ਕੇ ਆਪਣਾ ਕੰਮ ਸ਼ੁਰੂ ਕਰ ਦਿੰਦੀ ਹਾਂ ਵੀ ਕਿਸ ਟਾਈਮ ਮੈਂ ਘਰ ਦਾ ਕੰਮ ਕਰਨਾ ਹੈ ਕਿਸ ਟਾਈਮ ਮੈਂ ਬਾਹਰ ਜਾਣਾ ਹੈ ਅਤੇ ਕਿਸ ਟਾਈਮ ਮੈਂ ਖਾਣਾ ਬਣਾਉਣਾ ਹੈ ਅਤੇ ਕਿਸ ਟਾਈਮ ਮੈਂ ਪੜ੍ਹਣਾ ਹੈ ਅਤੇ ਕਿਸ ਟਾਈਮ ਸੌਣਾ ਹੈ